ਪੰਜਾਬ ਵਿੱਚ ਘਰ ਵਿੱਚ ਹੀ ਘਰੇਲੂ ਇਲਾਜ ਕਰਕੇ ਬਿਮਾਰੀ ਨੂੰ ਠੀਕ ਕਰਨ ਦਾ ਯਤਨ ਕਰਦੇ ਹਨ ਜਿਵੇਂ ਕਿ ਕਿਸੇ ਬੱਚੇ ਨੂੰ ਜਾਂ ਕਿਸੇ ਬਜ਼ੁਰਗ ਨੂੰ ਖਾਂਸੀ ਲੱਗੀ ਹੋਵੇ ਉਸ ਨੂੰ ਮੁਲੱਠੀ ਤੁਲਸੀ ਵਿੱਚ ਪੱਤੇ ਪਾ ਕੇ ਉਸਦੀ ਚਾਹ ਬਣਾ ਕੇ ਉਸਨੂੰ ਦਿੰਦੇ ਹਨ ਤਾਂ ਉਸ ਉਸ ਦੀ ਖਾਂਸੀ ਠੀਕ ਹੋ ਜਾਂਦੀ ਹੈ ਜੇਕਰ ਕਿਸੇ ਨੂੰ ਜ਼ੁਕਾਮ ਹੋਵੇ ਤਾਂ ਘਿਓ ਅਤੇ ਦੇਸੀ ਘਿਓ ਦੇ ਵਿੱਚ ਖਸਖਸ ਪਾ ਕੇ ਬਦਾਮ ਪਾ ਕੇ ਅਤੇ ਵਿੱਚ ਦੁੱਧ ਪਾ ਕੇ ਉਸਨੂੰ ਦੋਧੀ ਬਣਾ ਕੇ ਦਿੰਦੇ ਆ ਤਾਂ ਉਸਦਾ ਜ਼ੁਕਾਮ ਠੀਕ ਹੁੰਦਾ ਹੈ ਜੇਕਰ ਕਿਸੇ ਨੂੰ ਬ ਵਾਇਰਲ ਬੁਖਾਰ ਹੋਵੇ ਤਾਂ ਉਸਨੂੰ ਗਲੋ ਦੇ ਵਿੱਚ ਪਪੀਤੇ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਦਿੱਤੇ ਜਾਣ ਤਾਂ ਉਸ ਦਾ ਬੁਖਾਰ ਠੀਕ ਹੋ ਜਾਂਦਾ ਹੈ ਜੇਕਰ ਕਿਸੇ ਦੇ ਪੇਟ ਦੇ ਵਿੱਚ ਦਰਦ ਹੋਵੇ ਤਾਂ ਉਸ ਨੂੰ ਪਾਣੀ ਦੇ ਨਾਲ ਅਜਵਾਇਨ ਦਿੱਤੀ ਜਾਂਦੀ ਹੈ ਅਤੇ ਉਸ ਦੀ ਉਸਦਾ ਪੇਟ ਦਰਦ ਠੀਕ ਹੋ ਜਾਂਦਾ ਹੈ ਜੇਕਰ ਕਿਸੇ ਬੱਚੇ ਦੇ ਸੱਟ ਲੱਗ ਜਾਵੇ ਤਾਂ ਉਸ ਨੂੰ ਉਸ ਨੂੰ ਸਰ੍ਹੋਂ ਦੇ ਤੇਲ ਦੇ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਉਸ ਦੇ ਉੱਤੇ ਮਲਮ ਲਾ ਵਾਂਗ ਮਲ ਕੇ ਉਸਦੀ ਪੱਟੀ ਕੀਤੀ ਜਾਂਦੀ ਤਾਂ ਉਹ ਠੀਕ ਹੋ ਜਾਂਦਾ ਹੈ ਇਸ ਤਰ੍ਹਾਂ ਜੇਕਰ ਕਿਸੇ ਬਜ਼ੁਰਗ ਦੀਆਂ ਲੱਤਾਂ ਵਗੈਰਾ ਥਕਾਵਟ ਹੋ ਜਾਵੇ ਤਾਂ ਉਸ ਨੂੰ ਗਰਮ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਲੂਣ ਪਾ ਕੇ ਉਸ ਵਿਚ ਪੈਰ ਰੱਖ ਕੇ ਉਸ ਨੂੰ ਆਰਾਮ ਮਿਲਦਾ ਹੈ ਇਸ ਤਰ੍ਹਾਂ ਪੰਜਾਬ ਵਿਚ ਕਈ ਇਹੋ ਜਿਹੇ ਇਲਾਜ ਹਨ ਜੋ ਕਿ ਘਰ ਵਿਚ ਹੀ ਘਰੇਲੂ ਨੁਸਕਿਆਂ ਨਾਲ ਕਰ ਦਿੱਤੇ ਜਾਂਦੇ ਹਨ